ਭਾਰਤ ਵਿੱਚ ਸਿਹਤ ਸੰਭਾਲ ਪ੍ਰਣਾਲੀ ਹੈ ਜਿਹੜੀ ਉਹ ਦੂਸਰੇ ਦੇਸ਼ਾਂ ਦੇ ਮੁਕਾਬਲੇ ਜੇ ਵੇਖੀਏ ਬਹੁਤ ਦੇਸ਼ਾਂ ਦੇ ਨਾਲੋਂ ਚੰਗੀ ਹੈ ਅਤੇ ਬਹੁਤ ਦੇਸ਼ਾਂ ਦੇ ਨਾਲੋਂ ਆ ਜਿਹੜੀ ਮਾੜੀ ਹੈ ਸਾਡੇ ਨਜ਼ਦੀਕ ਹਸਪਤਾਲਾਂ ਕਲੀਨਕਾਂ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਅਤੇ ਇਹ ਖੇਤਰ ਦੇ ਹਿਸਾਬ ਨਾਲ ਨਿਰਭਰ ਕਰਦਾ ਹੈ ਕਈ ਖੇਤਰਾਂ ਦੇ ਵਿਚ ਹਸਪਤਾਲ ਕਲੀਨਿਕ ਬਹੁਤ ਚੰਗੇ ਵੀ ਨੇ ਕਈ ਖੇਤਰਾਂ ਦੇ ਵਿੱਚ ਮਾੜੇ ਵੀ ਨੇ ਅਤੇ ਸ਼ਾਇਦ ਮੈਨੂੰ ਲੱਗਦਾ ਵਈ ਇਹ ਥੋੜ੍ਹਾ ਜਿਹਾ ਲੋਕਲ ਲੈਵਲ ਦੇ ਉੱਤੇ ਰਾਜਨੀਤਿਕ ਪੱਧਰ ਦੇ ਉੱਤੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਈ ਜਗ੍ਹਾ ਦੇ ਉੱਤੇ ਚੰਗੇ ਹਸਪਤਾਲ ਕਲੀਨੀਕ ਹੈ ਜਿਹੜੇ ਰਾਜਨੀਤਿਕ ਲੋਕਾਂ ਦੇ ਵੱਲੋਂ ਐਮ ਐਲ ਏ ਐਮ ਪੀ ਆਂ ਵੱਲੋਂ ਬਣਾਏ ਗਏ ਨੇ ਅਤੇ ਕਈ ਜਗ੍ਹਾ ਦੇ ਉੱਤੇ ਜਿਹੜੇ ਉਹ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਉੱਥੇ ਚੰਗੀ ਤਰ੍ਹਾਂ ਕੋਈ ਡਾਕਟਰ ਵਗੈਰਾ ਵੀ ਨਹੀਂ ਹਨ ਪੂਰੀਆਂ ਸੁਵਿਧਾਵਾਂ ਵੀ ਨਹੀਂ ਹਨ ਵਿਸ਼ੇਸ਼ ਤੌਰ 'ਤੇ ਜਦੋਂ ਅਸੀਂ ਕਿਸੇ ਹਸਪਤਾਲ ਕਲੀਨਿਕ ਦੇ ਵਿੱਚ ਜਾਂਦੇ ਹਾਂ ਵਿਸ਼ ਜਿਹੜੀਆਂ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਦੋ ਤਿੰਨ ਵਿਸ਼ੇਸ਼ ਜਿਹੜੀਆਂ ਖ਼ਾਸ ਕਰਕੇ ਕੁਝ ਸਮੱਸਿਆਵਾਂ ਨੇ ਖ਼ਾਸ ਕਰਕੇ ਸਫ਼ਾਈ ਦੀ ਸਮੱਸਿਆ ਜਿਹੜੀ ਹੈ ਉਹ ਬਹੁਤ ਜ਼ਿਆਦਾ ਆਉਂਦੀ ਹੈ ਸਫ਼ਾਈ ਤੋਂ ਬਾਅਦ ਇਹ ਹੈ ਵੀ ਪਰਚੀ ਕਟਵਾਉਣ ਵੇਲੇ ਵੀ ਦੇਖਦੇ ਹਾਂ ਅਸੀਂ ਬਹੁਤ ਲੰਬੀਆਂ ਲੰਬੀਆਂ ਜਿਹੜੀਆਂ ਉਹ ਕਤਾਰਾਂ ਲੱਗੀਆਂ ਹੁੰਦੀਆਂ ਨੇ ਘੰਟੇ ਘੰਟੇ ਬੱਧੀ ਸਾਨੂੰ ਪਰਚੀ ਮਹਿਜ ਪਰਚੀ ਕਟਵਾਉਣ ਦੇ ਲਈ ਡਾਕਟਰ ਤਾਂ ਇੱਕ ਪਾਸੇ ਰਹਿ ਗਿਆ ਇਕੱਲੀ ਪਰਚੀ ਕਟਵਾਉਣ ਦੇ ਲਈ ਸਾਨੂੰ ਕਈ ਕਈ ਘੰਟੇ ਹੈ ਜਿਹੜਾ ਉਹ ਕਤਾਰਾਂ ਦੇ ਵਿੱਚ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਫਿਰ ਇਹ ਹੁੰਦਾ ਕਈ ਵਾਰ ਤੁਹਾਨੂੰ ਵਈ ਪਰਚੀ ਵੀ ਕਟਾ ਲੈਂਦੇ ਹੋ ਤੁਸੀਂ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਅਤੇ ਚੱਲੋ ਸਫ਼ਾਈ ਵੀ ਕਿੱਤੇ ਨਾ ਕਿੱਤੇ ਜਦੋਂ ਠੀਕ ਠਾਕ ਹੁੰਦੀ ਹੈ ਪਹਿਲਾਂ ਤਾਂ ਡੋਕਟਰ ਨਹੀਂ ਮਿਲਦਾ ਜੇ ਕਈ ਵਾਰ ਡੋਕਟਰ ਮਿਲ ਵੀ ਜਾਵੇ ਤਾਂ ਤੁਹਾਨੂੰ ਉਸ ਪੱਧਰ ਦਾ ਉਹਦੇ ਵੱਲੋਂ ਟ੍ਰੀਟਮੈਂਟ ਨਹੀਂ ਮਿਲਦਾ ਅਤੇ ਹਾਂ ਇਨ੍ਹਾਂ ਤਿੰਨਾਂ ਚਾਰਾਂ ਗੱਲਾਂ ਦੇ ਵਿੱਚ ਹੀ ਸਫ਼ਾਈ ਨੂੰ ਲੈ ਕੇ ਸਮੇਂ ਨੂੰ ਲੈ ਕੇ ਡੋਕਟਰ ਦੀਆਂ ਸੇਵਾਵਾਂ ਨੂੰ ਲੈ ਕੇ ਇਹਦੇ ਵਿੱਚ ਬਿਲਕੁਲ ਸੁਧਾਰ ਹੋਣਾ ਚਾਹੀਦਾ ਇਹ ਆਮ ਜਨਤਾ ਦੀ ਜਿਹੜੀ ਵਿਸ਼ੇਸ਼ ਤੌਰ 'ਤੇ ਮੰਗ ਹੈ ਧੰਨਵਾਦ